ਹੈਲੋ ਜੀ ਮੈਂ ਯਸ਼ਪ੍ਰੀਤ ਬੋਲ ਰਿਹਾ ਜੀ ਤੁਸੀਂ ਨਿੱਜਰ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਹਾਂਜੀ ਅਸੀਂ ਤੇਰਾਂ ਤਾਰੀਕ ਨੂੰ ਲੋਹੜੀ ਵਾਲੇ ਦਿਨ ਤੁਹਾਡੇ ਰੈਸਟੋਰੈਂਟ ਵਿੱਚ ਡਿਨਰ ਕਰਨਾ ਚਾਹੁੰਦੇ ਹਾਂ ਜੀ ਹਾਂਜੀ ਅਸੀਂ ਨਾਮ ਬਹੁਤ ਸੁਣਿਆ ਤੁਹਾਡਾ ਜੀ ਹਾਂਜੀ ਹਾਂਜੀ ਅਸੀਂ ਪਰਿਵਾਰ ਸਮੇਤ ਆਵਾਂਗੇ ਜੀ ਹਾਂਜੀ ਤਕਰੀਬਨ ਅਸੀਂ ਦਸ ਬੰਦੇ ਹੋਵਾਂਗੇ ਹਾਂਜੀ ਹਾਂਜੀ ਫੈਮਲੀ ਮੈਂਬਰਸ ਹਾਂਜੀ ਕੋਈ ਰਿਲੇਟਿਵ ਵੀ ਹੋਣਗੇ ਹਾਂਜੀ ਤੁਹਾਡੇ ਕੋਲ ਸੱਤ ਤੋਂ ਅੱਠ ਦੇ ਵਿਚਕਾਰ ਪਹੁੰਚਾਂਗੇ ਜੀ ਅਸੀਂ ਹਾਂਜੀ ਅਤੇ ਤੁਸੀਂ ਆਹ ਦੱਸੋ ਜੀ ਜੀ ਸਾਨੂੰ ਕੋਰਨਰ ਵਾਲਾ ਟੇਬਲ ਅਰੇਂਜ ਹੋ ਸਕਦਾ ਜੀ ਹਾਂਜੀ ਕੋਰਨਰ ਵਾਲਾ ਟੇਬਲ ਅਰੇਂਜ ਹੋ ਜਾਵੇ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਹਾਂਜੀ ਸਰ ਹਾਂਜੀ ਹਾਂਜੀ ਅਤੇ ਪਰ ਪਾਰਕਿੰਗ ਦੀ ਸੁਵਿਧਾ ਕੀ ਹੈ ਸਰ ਤੁਹਾਡੀ ਆਪਣੀ ਪਾਰਕਿੰਗ ਹੈ ਕਿ ਗੱਡੀ ਰੋਡ ਉੱਤੇ ਖੜੀ ਕਰਨੀ ਪਵੇਗੀ ਹਾਂਜੀ ਪਾਰਕਿੰਗ ਦੇ ਬੰਦ ਹੋਣ ਦਾ ਸਮਾਂ ਕੀ ਹੈ ਠੀਕ ਹੈ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਆਪਾਂ ਤੇਰਾਂ ਜਨਵਰੀ ਨੂੰ ਜੀ